ਮੈਂ ਸਵੀਗੀ ਤੋਂ ਓਪੋ ਦਾ ਫ਼ੋਨ ਆਡਰ ਕੀਤਾ ਸੀ ਜੋ ਕਿ ਬਹੁਤ ਹੀ ਰਿਆਇਤ ਵਿੱਚ ਮਿਲ ਗਿਆ ਅਤੇ ਇਸ ਵਿੱਚ ਫੀਚਰਸ ਵੀ ਬਹੁਤ ਜ਼ਿਆਦਾ ਹਨ ਮੈਂ ਪਹਿਲਾਂ ਇੱਕ ਫ਼ੋਨ ਦੁਕਾਨ ਤੋਂ ਹੀ ਖਰੀਦਿਆ ਸੀ ਪਰ ਉਹ ਮੈਨੂੰ ਬਹੁਤ ਮਹਿੰਗਾ ਲੱਗਾ ਸੀ ਜਦੋਂ ਕਿ ਔਨਲਾਇਨ ਫ਼ੋਨ ਸਸਤਾ ਤਾਂ ਮਿਲਿਆ ਹੀ ਨਾਲ ਦੀ ਨਾਲ ਇਹ ਸਹੀ ਟਾਇਮ 'ਤੇ ਡੇਟ 'ਤੇ ਵੀ ਪਹੁੰਚ ਗਿਆ ਜਦੋਂ ਇਹ ਮੈਨੂੰ ਦਿਖਾ ਰਿਹਾ ਸੀ ਉਸ ਤੋਂ ਵੀ ਪਹਿਲਾਂ ਮੇਰੇ ਘਰ ਪਹੁੰਚ ਗਿਆ ਸੀ ਇਸ ਦਾ ਰੰਗ ਵੀ ਮੈਨੂੰ ਬਹੁਤ ਪਸੰਦ ਆਇਆ ਇਸ ਦੀਆਂ ਸਾਰੀਆਂ ਹੀ ਫੀਚਰਸ ਬਹੁਤ ਵਧੀਆ ਹਨ ਹੈ ਵੀ ਫਾਇਵ ਜੀ ਜੋ ਕਿ ਮੈਨੂੰ ਚਾਹੀਦਾ ਸੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਇਹ ਸਸਤੇ ਵਿੱਚ ਮਿਲ ਗਿਆ